ਹਾਂਜੀ ਮੈਂ ਨਾ ਤੁਹਾਡੀ ਐਪ ਤੋਂ ਪ੍ਰੋਡੈਕਟ ਮੰਗਵਾਇਆ ਮੈਨੂੰ ਤੁਹਾਡਾ ਪ੍ਰੋਡੈਕਟ ਨਾ ਬਹੁਤ ਜ਼ਿਆਦਾ ਪਸੰਦ ਆਇਆ ਇੱਕ ਤਾਂ ਇਹ ਮੇਰੇ ਬਜਟ ਵਿੱਚ ਸੀ ਉੱਤੋਂ ਇਹ ਮੇਰੀ ਉਮੀਦ ਤੋਂ ਵਧੀਆ ਮੈਂ ਸੋਚਿਆ ਨਹੀਂ ਸੀ ਕਿ ਇੰਨੇ ਪੈਸਿਆਂ ਵਿੱਚ ਇੰਨਾਂ ਪਿਆਰਾ ਡਿਨਰ ਸੈੱਟ ਮੈਨੂੰ ਮਿਲ ਜਾਵੇਗਾ ਇਹ ਬਜ਼ਾਰੋਂ ਵਾਲੇ ਡਿਨਰ ਸੈੱਟ ਤੋਂ ਕਿਤੇ ਵਧੀਆ ਹੈ ਇਸ ਦੇ ਡਿਜ਼ਾਇਨ ਅਤੇ ਕਲਰ ਬਿਲਕੁਲ ਵੱਖਰਾ ਹੈ ਮੈਂ ਬਜ਼ਾਰ ਵਿੱਚ ਜਾ ਜਾ ਕੇ ਬਹੁਤ ਵਾਰ ਡਿਨਰ ਸੈੱਟ ਵੇਖੇ ਆ ਪਰ ਉਹ ਜਾਂ ਤਾਂ ਮੈਨੂੰ ਪਸੰਦ ਨਹੀਂ ਸੀ ਆਉਂਦਾ ਜਾ ਰੇਟ ਇੰਨਾਂ ਜ਼ਿਆਦਾ ਹੁੰਦਾ ਸੀ ਕਿ ਮੇਰੇ ਬਜਟ ਤੋਂ ਬਾਹਰ ਹੋ ਜਾਂਦਾ ਸੀ ਜਦ ਮੈਂ ਤੁਹਾਡੀ ਐਪ 'ਤੇ ਆਹ ਡਿਨਰ ਸੈਟ ਵੇਖਿਆ ਮੈਨੂੰ ਉਦੋਂ ਹੀ ਬੜਾ ਪਸੰਦ ਆਇਆ ਪਰ ਇਹਨੂੰ ਦੇਖ ਕੇ ਵਰਤ ਕੇ ਹੋਰ ਵੀ ਵਧੀਆ ਲੱਗਾ ਕਿ ਜਦ ਸਾਡੇ ਘਰ ਮਹਿਮਾਨ ਆਏ ਅਤੇ ਮੈਂ ਖ ਖਾਣਾ ਖਵਾਉਣ ਵਾਸਤੇ ਨਾ ਇਹ ਡਿਨਰ ਸੈਟ ਕੱਢਿਆ ਤਾਂ ਜਦੋਂ ਉਹਨਾਂ ਦੇ ਅੱਗੇ ਰੱਖਿਆ ਤਾਂ ਉਹ ਵੀ ਕਹਿੰਦੇ ਇਹਦਾ ਰੰਗ ਅਤੇ ਡਿਜ਼ਾਇਨ ਤਾਂ ਬਹੁਤ ਹੀ ਵਧੀਆ ਉਹਨਾਂ ਨੇ ਮੇਰੇ ਡਿਨਰ ਸੈਟ ਦੀ ਬਹੁਤ ਤਾਰੀਫ ਕੀਤੀ ਅਤੇ ਉਹਨਾਂ ਨੇ ਵੀ ਮੇਰੇ ਮਤਲਬ ਡਿਨਰ ਸੈਟ ਨੂੰ ਪਸੰਦ ਕਰਕੇ ਮੇਰੇ ਕੋਲ ਤੁਹਾਡੀ ਐਪ ਦਾ ਪੁੱਛ ਕੇ ਇਹੀ ਡਿਨ ਇਹੋ ਜਿਹਾ ਹੀ ਡਿਨਰ ਸੈਟ ਔਡਰ ਵੀ ਕਰ ਲਿਆ ਅਤੇ ਜਦ ਮੈਂ ਇਸ ਨੂੰ ਵਰਤ ਕੇ ਧੋਤਾ ਤਾਂ ਇਸ 'ਤੇ ਮਤਲਬ ਕਿਸੇ ਵੀ ਸਬਜ਼ੀ ਦਾ ਦਾਗ ਨਹੀਂ ਪਿਆ ਨਹੀਂ ਤਾਂ ਅਕਸਰ ਹੁੰਦਾ ਨਾ ਕਿ ਜਦੋਂ ਵੀ ਆਪਾਂ ਸਬ ਕਟੋਰੀਆਂ ਵਰਤਦੇ ਹਾਂ ਤਾਂ ਉਹਦੇ 'ਤੇ ਅਕਸਰ ਹੀ ਸਬਜ਼ੀ ਦੇ ਦਾਗ ਲੱਗ ਜਾਂਦੇ ਹਲਦੀ ਦਾ ਦਾਗ ਓ ਰਹਿ ਜਾਂਦਾ ਅਤੇ ਉਹ ਚੰਗਾ ਨਹੀਂ ਲੱਗਦਾ ਪਰ ਇਹਨੂੰ ਜਦੋਂ ਧੋਤਾ ਤਾਂ ਇਹ ਬਿਲਕੁਲ ਹੀ ਨਵੇਂ ਵਰਗਾ ਰਿਹਾ ਸਾਡੇ ਆਸ ਪੜੋਸ ਵਾਲਿਆਂ ਨੇ ਵੀ ਇਹ ਸੈਟ ਦੇਖ ਕੇ ਮਤਲਬ ਤੁਹਾਡੀ ਐਪ ਤੋਂ ਡਿਨਰ ਸੈਟ ਮੰਗਵਾਇਆ ਮੈਂ ਖੁਦ ਵੀ ਹੋਰ ਸਮਾਨ ਔਡਰ ਕੀਤਾ ਮੈਨੂੰ ਤੁਹਾਡੀ ਐਪ ਦਾ ਸਮਾਨ ਹੀ ਬਹੁਤ ਵਧੀਆ ਲੱਗਦਾ ਇੱਕ ਤਾਂ ਇਹ ਸਾਡੇ ਬਜਟ ਵਿੱਚ ਆ ਜਾਂਦਾ ਦੂਜਾ ਇਹ ਬਾਜ਼ਾਰ ਨਾਲੋਂ ਬਿਲਕੁਲ ਹੀ ਵੱਖਰੇ ਡਿਜ਼ਾਇਨ ਦਾ ਹੁੰਦਾ